ਹੈਲੋ ਹੋ ਸਤਿ ਸ਼੍ਰੀ ਅਕਾਲ ਬਾਈ ਜੀ ਕੀ ਹਾਲ ਚਾਲ ਨੇ ਹੋਰ ਕਿ ਕਿੱਦਾਂ ਚੱਲ ਰਹੀ ਹੈ ਤੁਹਾਡੀ ਸਟੱਡੀ ਅੱਛਾ ਜੀ ਤੁਹਾਨੂੰ ਤਕਲੀਫ਼ ਦੇਣ ਲਈ ਮਾਫ਼ੀ ਚਾਹੁੰਦਾ ਤਾਂ ਮੈਂ ਨਾ ਤੁਹਾਡੇ ਨਾਲ ਪੁੱਛਣਾ ਜਿਵੇਂ ਤੁਸੀਂ ਜਾਣਦੇ ਹੋ ਕਿ ਮੈਂ ਤੁਹਾਡੇ ਵਾਂਗੂ ਹੀ ਅਸੀਂ ਜਿਹੜੇ ਲੈਵਲ ਦੀ ਤਿਆਰੀ ਕਰ ਰਿਹਾ ਨਾ ਅਤੇ ਤੁਸੀਂ ਵੀ ਆਨਲਾਈਨ ਕਲਾਸਾਂ ਲੈਂਦੇ ਹੋ ਅਤੇ ਮੇਰੇ ਨਾ ਇੱਕ ਸਮੱਸਿਆ ਆ ਰਹੀ ਹੈ ਜੀ ਮੈਂ ਮਤਲਬ ਕਲਾਸਾਂ ਲਾ ਰਿਹਾ ਪਰ ਜਿਹੜਾ ਇਹ ਕਿ ਮੇਰਾ ਇੰਟਰਨੈਟ ਨਾ ਛੇਤੀ ਹੀ ਖ਼ਤਮ ਹੋ ਜਾਂਦਾ ਹੈ ਪਲੈਨ ਜਿਹੜਾ ਮੈ ਪਵਾਇਆ ਵਾ ਵਧੀਆ ਪਵਾਇਆ ਵਾ ਪਰ ਫਿਰ ਵੀ ਉਹ ਪੂਰਾ ਨਹੀਂ ਪੈ ਰਿਹਾ ਅਤੇ ਅੱਧੇ ਦਿਨ ਦੇ ਵਿੱਚ ਜਿਹੜਾ ਉਹ ਖ਼ਤਮ ਹੋ ਜਾਂਦਾ ਅਤੇ ਬਾਕੀ ਜਿਹੜੇ ਲੈਕਚਰ ਆ ਮੇਰੇ ਮਿੱਸ ਹੁੰਦੇ ਜਾ ਰਹੇ ਹੈ ਅਤੇ ਮੈਨੂੰ ਸਮਝ ਨਹੀਂ ਆ ਰਹੀ ਮੈਂ ਕੀ ਕਰਾਂ ਮੈਂ ਅਕਸਟਰਾ ਡਾਟਾ ਵੀ ਪਵਾ ਕੇ ਦੇਖ ਲਿਆ ਪਰ ਉਹਦੇ ਵਿੱਚ ਕੋਈ ਹੱਲ ਨਹੀਂ ਹੋ ਰਿਹਾ ਇਸ ਕਰਕੇ ਮੈਂ ਕਿਹਾ ਤੁਸੀਂ ਵੀ ਲਾ ਰਹੇ ਤਾਂ ਤੁਸੀਂ ਸੁਜੈਸ਼ਨ ਕਰ ਦਿਓ ਕਿ ਕਿਸ ਤਰ੍ਹਾਂ ਮੈਂ ਆਪਣੇ ਜਿਹੜੀ ਕਲਾਸਾਂ ਨੂੰ ਮੈਂਟੇਨ ਕਰ ਸਕਾਂ ਤਾਂ ਜੋ ਇੰਟਰਨੈਟ ਦੀ ਸਟੇਬਲ ਹੈ ਅਤੇ ਮੇਰਾ ਮੇਰਾ ਨੁਕਸਾਨ ਵੀ ਜ਼ਿਆਦਾ ਨਾ ਹੋਵੇ ਅਤੇ ਹੋਰ ਜੀ ਦੱਸ ਸਕਦੇ ਤਾਂ ਵਧੀਆ ਅੱਛਾ ਜੀ ਚਲੋ ਠੀਕ ਹੈ ਜੀ ਫਿਰ ਮੈਂ ਮਤਲਬ ਐਕਸਟਰਾ ਜਿਹੜਾ ਡਾਟਾ ਜਿਹਾ ਪਾ ਲਵਾਂ ਅਤੇ ਅਗਰ ਫਿਰ ਵੀ ਨਾ ਤਾਂ ਗੱਲ ਬਣੀ ਹੈ ਤਾਂ ਫਾਈਬਰ ਦੀ ਜਿਹੜੀ ਯੋਜਨਾ ਸਭ ਤੋਂ ਵਧੀਆ ਹੈ ਚਲੋ ਜੀ ਚਲੋ ਮੈਂ ਫਿਰ ਇੰਝ ਕਰਦਾ ਕਿ ਪਹਿਲਾਂ ਇੱਕ ਐਕਸਟਰਾ ਡਾਟਾ ਪਾ ਕੇ ਦੇਖ ਲੈਂਦਾ ਹੈ ਨਾ ਅਗਰ ਫਿਰ ਵੀ ਪੂਰਾ ਨਾ ਹੁੰਦਾ ਹੋਵੇ ਤਾਂ ਫਿਰ ਫਾਈਬਰ ਤਾਂ ਹੈ ਹੀ ਹੈ ਜੀ ਫਾਈਬਰ ਦੇ ਤੁਸੀਂ ਮੈਨੂੰ ਕੀ ਕੀ ਉਹ ਹੈ ਹਾਂਜੀ ਅੱਛਾ ਜੀ ਡੇਲੀ ਦੀ ਦਸ ਜੀ ਬੀ ਠੀਕ ਹੈ ਜੀ ਇਸ ਹਿਸਾਬ ਨਾਲ ਤੇਰਾ ਕੀ ਆ ਤੁਸੀਂ ਵੀ ਇਹ ਹੀ ਵਰਤਦੇ ਹੋ ਅੱਛਾ ਜੀ ਠੀਕ ਹੈ ਬਾਈ ਜੀ ਫਿਰ ਕੋਈ ਨਹੀਂ ਮੈਂ ਅਕਸਟਰਾ ਡਾਟਾ ਕਰਕੇ ਦੇਖਦਾ ਫਿਰ ਨਹੀਂ ਤੋ ਜੇ ਅਗਲੇ ਮੰਥ ਤੋਂ ਪਲੈਨ ਇਹ ਖ਼ਤਮ ਹੁੰਦਾ ਹੈ ਤਾਂ ਫਿਰ ਮੈਂ ਉਹ ਫਾਈਬਰ ਦਾ ਵਾਈਫਾਈ ਦਾ ਪਲੈਨ ਜਿਹੜਾ ਲਗਾ ਲੂੰਗਾ ਤੇ ਜਿਸ ਤਰ੍ਹਾਂ ਕੰਟੀਨਊ ਮੇਰਾ ਕੋਈ ਨੁਕਸਾਨ ਨਾ ਹੋਵੇ ਚਲੋ ਠੀਕ ਆ ਭਾਅ ਜੀ ਥੈਂਕ ਯੂ ਧੰਨਵਾਦ ਮੈਨੂੰ ਜੀ ਹੈਲਪ ਕਰਨ ਲਈ ਜੀ ਬਹੁਤ ਬਹੁਤ ਸ਼ੁਕਰੀਆ ਅਤੇ ਉਹ ਚਲੋ ਜੀ ਠੀਕ ਹੈ